ਹੈਲੋ ਹਾਂਜੀ ਮੈਮ ਮੈਂ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਮੈਮ ਹਾਂਜੀ ਮੈਮ ਮੈਂ ਰੁਪਿੰਦਰ ਕੌਰ ਫਰੋਮ ਗੰਗਾ ਨਗਰ ਮੈਮ ਮੈਂ ਅੰਮ੍ਰਿਤਸਰ ਆਈ ਵਿਜਿਟ ਕੀਤਾ ਹੈ ਮੈਮ ਮੈਂ ਐਕਚੁਲੀ ਮੈਂ ਪਹਿਲੀ ਵਾਰੀ ਵਿਜਿਟ ਕੀਤਾ ਹੋਇਆ ਆ ਮੈਨੂੰ ਥੋੜ੍ਹੇ ਦਿਨ ਹੋ ਗਏ ਵਿਜਿਟ ਕੀਤਿਆਂ ਨੂੰ ਅੰਮ੍ਰਿਤਸਰ ਐਂਡ ਮੈਂ ਹਰਿਮੰਦਰ ਸਾਹਿਬ ਆਈ ਹੋਈ ਹਾਂ ਮੈਨੂੰ ਕਿਸੇ ਮੇਰੇ ਫਰੈਂਡ ਨੇ ਤੁਹਾਡਾ ਨੰਬਰ ਦਿੱਤਾ ਸੀ ਕਿਉਂਕਿ ਉਹ ਐਕਚੁਅਲ 'ਚ ਪਹਿਲਾਂ ਇੱਥੇ ਵਿਜਿਟ ਕਰ ਚੁੱਕੇ ਨੇ ਅਤੇ ਮੈਨੂੰ ਉਹਨਾਂ ਨੇ ਤੁਹਾਡੇ ਕੋਲ ਗਾਈਡੈਂਸ ਲੈਣ ਵਾਸਤੇ ਤੁਹਾਡਾ ਨੰਬਰ ਦਿੱਤਾ ਹੈ ਕੀ ਤੁਸੀਂ ਮੈਨੂੰ ਦੱਸ ਸਕਦੇ ਹੋ ਕਿ ਇੱਥੇ ਲੰਗਰ ਦਾ ਕਿਵੇਂ ਪ੍ਰਬੰਧ ਕੀ ਕਿੰਨੇ ਤੋਂ ਕਿੰਨੇ ਟਾਈਮ ਦਾ ਹੈ ਅਤੇ ਸੇਵਾ ਕਰਨ ਦਾ ਸਮਾਂ ਕੀ ਹੈ

ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਠੀਕ ਹੈ ਅੱਛਾ ਮੈਮ ਸੇਵਾ ਲੰਗਰ ਅਤੇ ਸੇਵਾ ਲਈ ਮੈਂ ਹੁਣ ਤੱਕ ਅੰਮ੍ਰਿਤਸਰ 'ਚ ਬਹੁਤ ਸੁਣਿਆ ਹੈ ਕਿ ਹਾਂ ਸੇਵਾ ਦਾ ਅਤੇ ਲੰਗਰ ਦਾ ਮਤਲਬ ਇੱਕ ਮਤਲਬ ਜੋ ਹੈ ਉਹ ਇੱਕ ਇਨਸਾਨ ਦੇ ਜੀਵਨ ਵਿੱਚ ਉੱਥੇ ਜਾ ਕੇ ਬਹੁਤ ਮਹੱਤਵ ਹੈ ਕੀ ਤੁਸੀਂ ਮੈਨੂੰ ਦੱਸ ਸਕਦੇ ਹੋ ਕਿ ਕੀ ਮਹੱਤਵ ਹੈ ਉਸਦਾ ਇੱਕ ਇਨਸਾਨ ਦੇ ਲਾਈਫ ਵਿੱਚ ਹਾਂਜੀ

ਹਾਂਜੀ ਹਾਂਜੀ ਠੀਕ ਹੈ ਓਕੇ ਓਕੇ ਥੈਂਕ ਯੂ ਸੋ ਮੱਚ ਮੈਮ ਬਹੁਤ ਵਧੀਆ ਲੱਗਿਆ ਗੱਲ ਕਰਕੇ ਹਾਂਜੀ ਥੈਂਕ ਯੂ